ਧਾਰਮਿਕ ਅੰਧ ਵਿਸ਼ਵਾਸ ਕਾਫੀ ਫੈਲੇ ਹੋਏ ਆ ਸਾਡੇ ਸਮਾਜ ਦੇ ਵਿੱਚ ਹਮੇ ਜਿਵੇਂ ਮ ਮੰਗਲਵਾਰ ਨੂੰ ਵੀਰਵਾਰ ਨੂੰ ਜਾਂ ਸ਼ਨੀਵਾਰ ਨੂੰ ਕੱਪੜੇ ਨਹੀਂ ਧੋਣੇ ਨਹੁੰ ਨਹੀਂ ਨਹੁੰ ਨਹੀਂ ਕੱਟਣੇ ਜਾਂ ਸਿਰ ਨਹੀਂ ਧੋਣਾ ਇਹੋ ਜਿਹੇ ਕਈ ਚੀਜ਼ਾਂ ਹੈਗੀਆਂ ਸੋ ਇਹ ਇਹ ਅੰਧ ਵਿਸ਼ਵਾਸ ਆ ਜਿਹੜੇ ਲੋਕਾਂ ਨੇ ਟਾਈਮਲੀ ਆਪਣੇ ਆਪ ਹੀ ਬਣਾ ਲਏ ਆ ਧਰਮ ਸਾਨੂੰ ਕੋਈ ਵੀ ਇਹਨਾਂ ਚੀਜ਼ਾਂ ਬਾਰੇ ਨਹੀਂ ਸਿਖਾਉਂਦਾ ਜੇ ਆਪਾਂ ਗੁਰਬਾਣੀ ਦੇ ਅਕੋਡਿੰਗ ਚਲੀਏ ਤਾਂ ਸਾਰੇ ਦਿਨ ਇੱਕੋ ਜਿਹੇ ਆ ਕੋਈ ਦਿਨ ਚੰਗਾ ਮਾੜਾ ਹੈ ਨਹੀਂ ਅਤੇ ਇਸ ਕਰਕੇ ਇਹਨਾਂ ਚੀਜ਼ਾਂ ਵੱਲ ਮਤਲਬ ਇਹਨਾਂ ਚੀਜ਼ਾਂ ਤੋਂ ਵਿਗਿਆਨਿਕ ਤੌਰ 'ਤੇ ਉਭਰਨ ਦੀ ਲੋੜ ਹੈ ਜਾਂ ਲੋਜਿਕ ਨਾਲ ਕਹਿ ਲਓ ਉੱਭਰਨ ਦੀ ਲੋੜ ਹੈ ਸੋ ਇਹਨਾਂ ਅੰਧ ਵਿਸ਼ਵਾਸਾਂ ਤੋਂ ਬਚਣਾ ਚਾਹੀਦਾ ਅਤੇ ਧਰਮ ਨੂੰ ਸਹੀ ਢੰਗ ਨਾਲ ਹੀ ਫੋਲੋ ਕਰਨਾ ਚਾਹੀਦਾ ਆ